ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਫ਼ਰਕ ਹੈ ਬਹੁਤ ਹੀ ਜ਼ਿਆਦਾ ਫ਼ਰਕ ਹੈ ਕਿਉਂਕਿ ਪੁਰਾਣੇ ਗੀਤਾਂ ਵਿੱਚ ਪਿਆਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਜਿਵੇਂ ਕਿ ਪੁਰਾਣੇ ਗੀਤਾਂ ਦੇ ਵਿੱਚੋਂ ਇੱਕ ਗੀਤ ਹੈ ਅਭੀ ਨਾ ਜਾਓ ਛੋੜ ਕਰ ਕੇ ਦਿਲ ਅਭੀ ਭਰਾ ਨਹੀਂ ਅਤੇ ਉਸ ਦੇ ਨਾਲ ਹੀ ਅੱਜ ਦੇ ਗੀਤਾਂ ਵਿੱਚ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਸਿੱਧੂ ਮੂਸੇ ਵਾਲੇ ਦੇ ਕਈ ਸੌਂਗ ਸੁਣਦੇ ਹਨ ਮਤਲਬ ਅੱਜ ਦੇ ਯੂਥ ਵਿਗੜ ਰਹੇ ਹਨ ਅੱਜ ਦੇ ਗੀ ਗੀਤਾਂ ਦੇ ਕਾਰਨ ਪੁਰਾਣੇ ਗੀਤ ਫਿਰ ਵੀ ਕਿਸੇ ਹੱਦ ਤੱਕ ਸਹੀ ਹੁੰਦੇ ਹਨ ਜਿਵੇਂ ਅੱਜ ਕੱਲ੍ਹ ਦੇ ਗੀਤ ਆ ਰਹੇ ਫਾਲਤੂ ਦੇ ਗੀਤ ਜਿਵੇਂ ਬਦਤਮੀਜ਼ ਦਿਲ ਆ ਜੋ ਵੀ ਅੱਜ ਕੱਲ੍ਹ ਦੇ ਖਰਾਬ ਚਾਲ ਚਲਨ ਚੱਲ ਰਿਹਾ ਹੈ ਅੱਜ ਕੱਲ੍ਹ ਮੁੰਡੇ ਕੁੜੀਆਂ ਦੇ ਪਿੱਛੇ ਪਾਗਲ ਹੋ ਰਹੇ ਹਨ ਮਤਲਬ ਅੱਜ ਕੱਲ੍ਹ ਦੇ ਜਿਹੜੇ ਗੀਤ ਨੇ ਬਹੁਤ ਹੀ ਖਰਾਬ ਹਨ ਪਹਿਲੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਰੋਟੀ ਇਹੋ ਜਿਹੇ ਗੀਤ ਬਣਦੇ ਸਨ ਅੱਜ ਦੇ ਗੀਤ ਫਿਰ ਵੀ ਬਹੁਤ ਹੀ ਮਤਲਬ ਪਿੱਛੇ ਹਨ ਪੁਰਾਣੇ ਗੀਤਾਂ ਦੇ ਮੁਕਾਬਲੇ ਇਸ ਕਰਕੇ ਪੁਰਾਣੇ ਗੀਤ ਸਹੀ ਹੁੰਦੇ ਹਨ ਜਿਵੇਂ ਕਿ ਪੁਰਾਣਾ ਇੱਕ ਗੀਤ ਮੈਨੂੰ ਯਾਦ ਆ ਰਿਹਾ ਜਿਹਦੇ ਵਿੱਚ ਕਿਹਾ ਜਾਂਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਜਿਸ ਦੇ ਵਿੱਚ ਪਰਿਵਾਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ ਅੱਜ ਕੱਲ੍ਹ ਤਾਂ ਦੁਨਾਲੀਆਂ ਹੋ ਗਈਆਂ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਅੱਜ ਕੱਲ੍ਹ ਬਹੁਤ ਹੀ ਗਲਤ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਅੱਜ ਦੇ ਗੀਤਾਂ ਦੇ ਵਿੱਚ